ਟੈਕਨੋਲੋਜੀ ਨੇ ਐਜੂਕੇਸ਼ਨ ਦੇ ਵਿੱਚ ਹੈਲਪ ਕੀਤੀ ਹੈ ਕਾਫ਼ੀ ਜ਼ਿਆਦਾ ਹੈਲਪ ਕੀਤੀ ਹੈ ਜਿੱਦਾਂ ਔਨਲਾਈਨ ਕਲਾਸਿਸ ਅਗਰ ਤੁਸੀਂ ਔਫਿਸ ਸਕੂਲ ਦੇ ਵਿੱਚੋਂ ਅਵੇਲੇਬਲ ਨਹੀਂ ਹੋ ਕੋਈ ਪ੍ਰੋਬਲਮਜ਼ ਆ ਰਹੀ ਜਿੱਦਾਂ ਕਿ ਪਿੱਛੇ ਕਰੋਨਾ ਆਇਆ ਸੀਗਾ ਅਤੇ ਬੱਚਿਆਂ ਦੀ ਪੜ੍ਹਾਈ ਜਿਹੜੀ ਉਹਦੇ 'ਤੇ ਫੈਕਟ ਨਹੀਂ ਹੋਣਾ ਚਾਹੀਦਾ ਅਤੇ ਉਹਦੇ ਲਈ ਔਨਲਾਈਨ ਐਜੂਕੇਸ਼ਨ ਪ੍ਰੋਵਾਈਡ ਕਰ ਦਿੱਤੀ ਸੀਗੀ ਹੁਣ ਇਹ ਹੈ ਕਿ ਔਫਿਸਸ ਦੇ ਲਈ ਤੁਸੀਂ ਆਪਣੀ ਡਿਵੈਲਪਮੈਂਟ ਕਰਨੀ ਹੈ ਸੈਲਫ ਡਿਵੈਲਪਮੈਂਟ ਦੇ ਲਈ ਕਾਫ਼ੀ ਸਾਰੇ ਕੋਰਸਿਸ ਨੇ ਜੋ ਔਨਲਾਈਨ ਅਵੇਲੇਬਲ ਨੇ ਔਨਲਾਈਨ ਕੋਂਨਫਰੈਂਸਿਸ ਅਟੈਂਡ ਕਰ ਸਕਦੇ ਹੋ ਔਨਲਾਈਨ ਸੈਮੀਨਾਰਜ਼ ਅਟੈਂਡ ਕਰ ਸਕਦੇ ਹੋ ਔਨਲਾਈਨ ਵਰਕਸੋਪਜ਼ ਅਟੈਂਡ ਕਰ ਸਕਦੇ ਹੋ ਸੋ ਹੁਣ ਤਾਂ ਇਹ ਕਿ ਸਾਰੇ ਜੇ ਕੁਛ ਡਿਜੀਟਲੀ ਇੰਨਾ ਜ਼ਿਆਦਾ ਐਕਸਪੈਂਡ ਹੋ ਚੁੱਕਿਆ ਕਿ ਤੁਸੀਂ ਐਡਮਿਸ਼ਨਜ਼ ਲੈਣੀਆਂ ਉਹ ਵੀ ਤੁਹਾਡੀਆਂ ਔਨਲਾਈਨ ਹੋ ਜਾਂਦੀਆਂ ਨੇ ਤੁਹਾਨੂੰ ਔਫਿਸਜ਼ ਸਕੂਲਜ਼ ਕੋਲਜਿਸ ਦੇ ਵਿੱਚ ਵਿਜਿਟ ਨਹੀਂ ਕਰਨੀ ਪੈਂਦੀ ਹੈਗੀ ਤੁਸੀਂ ਆਪਣਾ ਐਗਜ਼ਾਮਸ ਵੀ ਔਨਲਾਈਨ ਹੋ ਜਾਂਦੇ ਆ ਤਾਂ ਇਹ ਹੈ ਕਿ ਜਿੱਦਾਂ ਜਿੱਦਾਂ ਟੈਕਨੋਲੋਜੀ ਡਿਵੈਲਪ ਹੋ ਰਹੀ ਹੈ ਕਾਫ਼ੀ ਸਾਰੀਆਂ ਚੀਜ਼ਾਂ ਐਕਸਪੈਂਡ ਹੋ ਰਹੀਆਂ ਨੇ ਅੱਗੇ ਬੁੱਕਸ ਲੋਕ ਪ੍ਰੈਫਰ ਕਰਦੇ ਸੀਗੇ ਪੜ੍ਹਨਾ ਬਟ ਹੁਣ ਸਾਰਾ ਮਟੀਰੀਅਲ ਜਿਹੜਾ ਔਨਲਾਈਨ ਮਿਲ ਜਾਂਦਾ ਤੁਸੀਂ ਯੂਟੀਊਬ ਦੇ ਉੱਤੇ ਕੁਛ ਵੀ ਸਿੱਖਣਾ ਹੋਵੇ ਉਥੋਂ ਸਿੱਖ ਸਕਦੇ ਹੋ ਚੈਟ ਜੀ ਪੀ ਟੀ ਹੈ ਤੁਹਾਨੂੰ ਪ੍ਰੈਜੇਟੇਸ਼ਨ ਬਣਾਉਣ ਦੇ ਵਿੱਚ ਐਕਸਲ ਫਾਰਮੂਲਾਜ ਸਿੱਖਣ ਦੇ ਵਿੱਚ ਹੈਲਪ ਕਰ ਰਿਹਾ ਕਾਫੀ ਐਡਵਾਂਸਮੈਂਟ ਹੋ ਚੁੱਕੀ ਹੈ ਔਨਲਾਈਨ ਕੋਰਸਿਸ ਤੁਸੀਂ ਸਿਕਸ ਮੰਥਸ ਅਤੇ ਥਰੀ ਮੰਥਸ ਦੇ ਵਨ ਮੰਥ ਦਾ ਕੁਛ ਨਾ ਕੁਛ ਸਿੱਖਣਾ ਹੋਵੇ ਤੋ ਸਿੱਖਣ ਦੇ ਲਈ ਹੁਣ ਲਿਮਿਟ ਕੋਈ ਨਹੀਂ ਹੈ ਸਿਰਫ ਸਿਰਫ ਪਰਸਨ ਦੀ ਖੁਦ ਦੀ ਹੀ ਲਿਮਟ ਹੈ ਉਹ ਜਿੰਨਾ ਕੁਛ ਸਿੱਖਣਾ ਚਾਵੇ ਨੈਟ ਜਿਹੜਾ ਉਹਨੂੰ ਅਵੇਲੇਬਲ ਕਰਵਾ ਰਿਹਾ ਸਾਰਾ ਕੁਛ